ਸਤਿ ਸ਼੍ਰੀ ਅਕਾਲ ਜੀ ਤੁਸੀਂ ਵਾਕ ਬਾਰਕ ਬੁੱਕ ਸ਼ੋਪ ਤੋਂ ਬੋਲ ਰਹੇ ਹੋ ਹਾਂਜੀ ਮੈਨੂੰ ਨਾ ਤੁਹਾਡੇ ਤੋਂ ਇੱਕ ਗੱਲ ਪਤਾ ਕਰਨੀ ਸੀ ਕਿਉਂਕਿ ਜੀ ਤੁਹਾਡੇ ਕੋਲ ਕਿਹੜੇ ਕਿਹੜੇ ਕੋਰਸਿਸ ਦੀ ਬੁੱਕ ਅਵੇਲੇਬਲ ਹੈ ਠੀਕ ਹੈ ਜੀ ਤੁਹਾਡੇ ਕੋਲ ਬੀਟੈਕ ਹੈ ਆ ਆਰਕੀਟੈਕਚਰ ਦੀ ਬੁੱਕਸ ਮਿਲ ਜਾਣਗੀਆਂ ਨਹੀਂ ਮੈਨੂੰ ਇਹ ਪਤਾ ਕਰਨਾ ਸੀ ਜਿਵੇਂ ਮੈਂ ਹਜੇ ਸੈਕਿੰਡ ਸਮੈਸਟਰ ਆਪਣਾ ਕੰਪਲੀਟ ਕੀਤਾ ਅਤੇ ਉਸ ਤੋਂ ਬਾਅਦ ਮੈਨੂੰ ਜਿਵੇਂ ਆਪਣੀ ਅਗਲੇ ਸਮੈਸਟਰ ਦੀ ਬੁੱਕਸ ਲੈਣੀਆਂ ਸੀ ਤਾਂ ਤੁਸੀਂ ਪੁਰਾਣੇ ਬੁੱਕ ਲੈਂਦੇ ਲੈ ਕੇ ਵੀ ਕਿੰਨੇ ਪਰਸੈਂ ਲੈਂਦੇ ਹੋ ਕਿ ਮਤਲਬ ਕਿ ਪੁਰਾਣੀ ਬੁੱਕਸ ਲੈਂਦੇ ਹੋ ਅੱਛਾ ਮਤਲਬ ਕਿ ਤੁਹਾਡੇ ਕੋਲ ਜਿਹੜੀ ਅਗਲੇ ਸਮੈਸਟਰ ਦੀ ਬੁੱਕਸ ਹੈ ਉਹ ਵੀ ਪੁਰਾਣੀ ਹੈ ਪੁਰਾਣੀਆਂ ਹੈ ਨਵੀਆਂ ਹੈ ਦੋਨੋਂ ਮਿਲ ਜਾਣਗੀਆਂ ਜਿਵੇਂ ਜੀ ਮੈਂ ਨਾ ਸੈਕਿੰਡ ਸਮੈਸਟਰ ਆਪਣਾ ਕੰਪਲੀਟ ਕੀਤਾ ਅਤੇ ਹੁਣ ਮੈਂ ਨਾ ਅਗਲੇ ਆਪਣੇ ਥਰਡ ਸਮੈਸਟਰ ਦੀ ਬੁੱਕ ਚਾਹੀਦੀਆ ਹੈ ਜਿਵੇਂ ਮੈਥ ਦੀ ਹੋਣੀ ਜਿਵੇਂ ਕਾਫ਼ੀ ਪਾਰਟ ਨੇ ਜਿਵੇਂ ਛੇ ਪਾਰਟਸ ਨੇ ਮੈਥ ਦੀ ਬੁੱਕ ਦੇ ਤੇ ਉਵੇਂ ਛੇ ਪਾਰਟਸ ਮਿਲਣਗੇ ਜਾਂ ਮਤਲਬ ਅਧ ਅੱਧੇ ਮਿਲਣਗੇ ਜਿਵੇਂ ਸਾਰੇ ਪਾਰਟਸ ਅਵੇਲੇਬਲ ਮਿਲ ਜਾਣਗੇ ਤੁਹਾਡੇ ਕੋਲ ਉੱਥੋਂ ਅੱਛਾ ਤਾਂ ਸਿਰਫ਼ ਥਿਓਰੀ ਸਬਜੈਕਟ ਮਿਲਣਗੇ ਜਾਂ ਪ੍ਰੈਕਟੀਕਲ ਸਬਜੈਕਟ ਨਹੀਂ ਮਿਲ ਜਾਣਗੇ ਜਿਵੇਂ ਫਾਈਲਸ ਵਗੈਰਾ ਵੀ ਬਣਾਉਣੀ ਹੁੰਦੀ ਜਿਹੜੇ ਪ੍ਰੋਜੈਕਟ ਵਗੈਰਾ ਬਣਾਉਣੇ ਹੁੰਦੇ ਆ ਉਹਨਾਂ ਤੋਂ ਰਿਲੇਟਡ ਜਿਵੇਂ ਕਈ ਬੁੱਕਸ ਹੁੰਦੀਆਂ ਉਹ ਵੀ ਅੱਛਾ ਅਤੇ ਜਿਵੇਂ ਪਰੋ ਪ੍ਰੋਜੈਕਟ ਵਰਕ ਜਿਵੇਂ ਪ੍ਰੋਜੈਕਟ ਵਰਕ ਤਾਂ ਆਪ ਹੀ ਬਣਾਉਣਾ ਹੁੰਦਾ ਜਿਵੇਂ ਤਾਂ ਉਸ ਹਿਸਾਬ ਤੋਂ ਜਿਵੇਂ ਹੁਣ ਥੋੜ੍ਹਾ ਬਹੁਤ ਜਿਵੇਂ ਤੇ ਜਿਵੇਂ ਬੁੱਕਸ ਹੁੰਦੀਆਂ ਜਾਂ ਕੋਈ ਵੀ ਪ੍ਰੈਕਟੀਕਲ ਰਿਲੇਟਡ ਹੁੰਦੀਆਂ ਉਹ ਜੇ ਮਿਲ ਜਾਣ ਉਹ ਵੀ ਮਿਲ ਜਾਣਗੀਆਂ ਜੀ ਠੀਕ ਹੈ ਜੀ ਅਤੇ ਬੁੱਕ ਸ਼ੋਪ ਕਦੋਂ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਖੁੱਲੀ ਹੁੰਦੀ ਹੈ ਜੀ ਠੀਕ ਹੈ ਜੀ